ਹੈਲੋ ਗੁੱਡ ਆਫਟਰਨੂੰਨ ਸਰ ਹਾਂਜੀ ਸਰ ਮੈਂ ਉਹਦੇ ਲੈਕਚਰ ਰਿਗਾਰਡਿੰਗ ਤੁਹਾਡੇ ਨਾਲ ਗੱਲ ਕਰਨੀ ਸੀ ਕਿ ਤੁਸੀਂ ਐਕਚੁਲੀ ਟਾਈਮ ਟੇਬਲ ਦੇ ਰਿਗਾਰਡਿੰਗ ਕੀ ਆਪਣਾ ਟਾਈਮ ਟੇਬਲ ਸੈੱਟ ਤੁਸੀਂ ਕਰ ਲਿਆ ਪਰ ਉਹਦੇ 'ਚ ਲੈਕਚਰ ਥੋੜ੍ਹੇ ਤੁਸੀਂ ਮੇਰੇ ਹਿਸਾਬ ਨਾਲ ਮਤਲਬ ਠੀਕ ਨਹੀਂ ਪਾਏ ਮੇਰੇ ਜਿੱਦਾਂ ਦੇ ਮੈਨੂੰ ਥੋੜ੍ਹੇ ਠੀਕ ਲੱਗਦੇ ਆ ਹਾਂਜੀ ਸਰ ਨਹੀਂ ਉਹ ਤਾਂ ਓ ਉਹ ਤਾਂ ਮੈਂ ਤੁਹਾਡੀ ਗੱਲ ਤੋਂ ਬਿਲਕੁਲ ਉਹ ਇਤਫਾਕ ਰੱਖਦਾ ਹਾਂ ਕਿ ਹਾਂਜੀ ਕਿ ਅਸੀਂ ਪਰ ਲੇਕਿਨ ਗੱਲ ਕੀ ਹੈਗਾ ਕਿ ਸਵੇਰੇ ਕਈ ਵਾਰੀ ਮੈਂ ਲੇਟ ਹੋ ਜਾਂਦਾ ਠੀਕ ਹੈ ਬੱਚੇ ਨੂੰ ਤਿਆਰ ਕਰਕੇ ਭੇਜਣਾ ਹੁੰਦਾ ਹੈ ਵਾਈਫ ਸਕੂਲ ਜਾਂਦੀ ਹੈ ਤਾਂ ਇਹ ਜ਼ਿੰਮੇਵਾਰੀ ਮੇਰੀ ਆ ਮੈਨੂੰ ਹੁੰਦਾ ਹੈ ਕਿ ਅੱਧਾ ਘੰਟਾ ਮੈਂ ਕਈ ਵਾਰੀ ਲੇਟ ਹੋ ਜਾਂਦਾ ਤਾਂ ਫਿਰ ਮੈਨੂੰ ਕੀ ਆ ਪੰਦਰਾਂ ਮਿੰਟ ਲੇਟ ਹੋ ਜਾਂਦਾ ਤਾਂ ਬੱਚੇ ਉਹ ਮਤਲਬ ਉਹ ਕਰਦੇ ਆ ਕਿ ਬੱਚਿਆਂ ਨੂੰ ਕੁ ਸਹਿਣਾ ਪੈਂਦਾ ਹੈ ਕਲਾਸ 'ਚ ਤਾਂ ਮੈਨੂੰ ਤਾਂ ਸੀਗਾ ਕਿ ਥੋੜ੍ਹਾ ਮੇਰਾ ਸੈਕੰਡ ਲੈਕਚਰ ਲਗਾ ਦਿੰਦੇ ਜਾਂ ਫਿਰ ਤੁਸੀਂ ਦੁਪਹਿਰ ਤੋਂ ਬਾਅਦ ਰੱਖ ਦਿੰਦੇ ਮੇਰੇ ਭਾਵੇਂ ਇਕੱਠੇ ਦੋ ਰੱਖ ਦਿਉ ਮੈਨੂੰ ਉਹਦੇ 'ਚ ਕੋਈ ਚੱਕਰ ਨਹੀਂ ਹੈਗਾ ਕੋਈ ਇਸ਼ੂ ਨਹੀਂ ਹੈਗਾ ਤੁਸੀਂ ਉਸ ਹਿਸਾਬ ਨਾਲ ਕਰ ਦਿਉ ਭਾਵੇਂ ਮੈਨੂੰ ਪਹਿਲਾ ਲੈਕਚਰ ਨਾ ਦਿਉ ਅਤੇ ਇੱਕ ਮੈਨੂੰ ਲਾਸਟ ਲੈਕਚਰ ਨਾ ਦਿਉ ਜਿਹਦੇ ਲਾਸਟ 'ਚ ਕੀ ਹੁੰਦਾ ਹੈ ਕਿ ਬੱਚੇ ਛੇਤੀ ਘਰ ਚਲੇ ਜਾਂਦੇ ਆ ਫਿਰ ਕਲਾਸ 'ਚ ਕੋਈ ਰਹਿੰਦਾ ਨਹੀਂ